ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਕਈ ਤਰ੍ਹਾਂ ਦੇ ਤਿਉਹਾਰ ਮਨਾਏ ਜਾਂਦੇ ਹਨ ਇਹਨਾਂ ਵਿੱਚ ਪ੍ਰਮੁੱਖ ਤਿਉਹਾਰ ਦਿਵਾਲੀ ਲੋਹੜੀ ਅਤੇ ਗੁਰਪੁਰਬ ਹਨ ਇੱਥੇ ਹਰ ਸੱਭਿਆਚਾਰ ਦੇ ਲੋਕ ਮਿਲਜੁਲ ਕੇ ਰਹਿੰਦੇ ਹਨ ਇਸ ਲਈ ਹਿੰਦੂ ਭਾਈਚਾਰੇ ਦੇ ਤਿਉਹਾਰ ਅਤੇ ਮੁਸਲਮਾਨ ਭਾਈਚਾਰੇ ਦੇ ਅਤੇ ਈਸਾਈ ਭਾਈਚਾਰੇ ਦੇ ਤਿਉਹਾਰ ਵੀ ਇੱਥੇ ਬੜੇ ਧੂਮਧਾਮ ਨਾਲ਼ ਮਨਾਏ ਜਾਂਦੇ ਹਨ ਜਿਵੇਂ ਕਿ ਕ੍ਰਿਸਮਿਸ ਹੋ ਅਤੇ ਜਨਮਅਸ਼ਟਮੀ ਹੋ ਗਿਆ ਸਾਰੇ ਤਿਉਹਾਰ ਜੋ ਨੇ ਉਹ ਮਨਾਏ ਜਾਂਦੇ ਨੇ ਇੱਥੇ ਦੁਰਗਾ ਪੂਜਾ ਅਤੇ ਗਣੇਸ਼ ਉਤਸਵ ਵੀ ਮਨਾਇਆ ਜਾਂਦਾ ਹੈ ਇਹ ਖੇਤਰੀ ਭਾਵ ਹੋਣ ਕਰਕੇ ਇੱਥੇ ਵਿਸ਼ਕਰਮਾ ਡੇ ਵੀ ਬੜੀ ਧੂਮਧਾਮ ਨਾਲ਼ ਮਨਾਇਆ ਜਾਂਦਾ ਹੈ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਇੱਕ ਪਿੰਡ ਖਟਕੜ ਕਲਾਂ ਜੋ ਕਿ ਸ਼ਹੀਦ ਭਗਤ ਸਿੰਘ ਦਾ ਜੱਦੀ ਘਰ ਹੈ ਉਹ ਸਥਿਤ ਹੈ ਅਤੇ ਉੱਥੇ ਭਗਤ ਸਿੰਘ ਦੀ ਯਾਦ ਵਿੱਚ ਮਿਊਜ਼ੀਅਮ ਵੀ ਬਣਾਇਆ ਗਿਆ ਹੈ ਜਿੱਥੇ ਹਰ ਸਾਲ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਨ ਬੜੇ ਧੂਮਧਾਮ ਨਾਲ਼ ਮਨਾਇਆ ਜਾਂਦਾ ਹੈ ਅਤੇ ਤਿੰਨ ਦਿਨ ਦਾ ਮੇਲਾ ਲੱਗਦਾ ਹੈ ਇਹ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਪ੍ਰਮੁੱਖ ਇੱਕ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਇਸ ਨੂੰ ਹੋਰ ਵੀ ਕਈ ਸਾਰੇ ਤਿਉਹਾਰ ਨੇ ਜਿਹਨਾਂ ਨੂੰ ਸਾਰੇ ਜ਼ਿਲ੍ਹੇ ਦੇ ਲੋਕ ਮਿਲਜੁਲ ਕੇ ਮਨਾਉਂਦੇ ਹਨ